ਪਿੰਡ ਦੇ ਬਜ਼ੁਰਗ ਮੰਜੇ 'ਤੇ ਪੈ ਜਾਂਦੇ ਹਨ ਇਸ ਦੇ ਬਹੁਤ ਸਾਰੇ ਕਾਰਨ ਹਨ ਪਹਿਲਾ ਜੋ ਮੁੱਖ ਕਾਰਨ ਹੈ ਉਹ ਹੈ ਵਾਤਾਵਰਨ ਵਿੱਚ ਵੱਧ ਰਿਹਾ ਪ੍ਰਦੂਸ਼ਣ ਪਹਿਲਾਂ ਦੀਆਂ ਹਵਾਵਾਂ ਸਾਫ ਹੁੰਦੀਆਂ ਸਨ ਅਤੇ ਹੁਣ ਵਾਤਾਵਰਨ ਵਿੱਚ ਇੰਨਾ ਸਾਰਾ ਪ੍ਰਦੂਸ਼ਣ ਵੱਧ ਗਿਆ ਹੈ ਜਿਸ ਨਾਲ ਬਜ਼ੁਰਗਾਂ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਦੂਜਾ ਵੱਡਾ ਕਾਰਨ ਇਹ ਹੈ ਕਿ ਜਿਵੇਂ ਪਹਿਲਾਂ ਸਾਨੂੰ ਖਾਣ ਪੀਣ ਦੀਆਂ ਚੀਜ਼ਾਂ ਸ਼ੁੱਧ ਅਤੇ ਸਾਫ ਮਿਲਦੀਆਂ ਸਨ ਹੁਣ ਹਰ ਚੀਜ਼ਾਂ ਦੇ ਵਿੱਚ ਮਿਲਾਵਟੀ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਜੋ ਕਿ ਸਾਨੂੰ ਪੂਰੇ ਤਰੀਕੇ ਦੇ ਨਾਲ ਪੋਸ਼ਣ ਨਹੀਂ ਦਿੰਦੀਆਂ ਅਤੇ ਜਿਸ ਦੇ ਕਾਰਨ ਬਜ਼ੁਰਗ ਬਿਮਾਰ ਹੋ ਜਾਂਦੇ ਹਨ ਅਤੇ ਪਰਿਵਾਰਕ ਮੈਂਬਰ ਉਹਨਾਂ ਦੀ ਦੇਖਭਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਦੇ ਹਨ ਬਜ਼ੁਰਗਾਂ ਨੂੰ ਸਮੇਂ ਸਮੇਂ 'ਤੇ ਡਾਕਟਰ ਦੇ ਕੋਲ ਮੁਆਇਨਾ ਕਰਵਾਉਂਦੇ ਹਨ ਅਤੇ ਦਵਾਈਆਂ ਬੂਟੀਆਂ ਬਜ਼ੁਰਗਾਂ ਨੂੰ ਆਪਣੇ ਤਰੀਕੇ ਦੇ ਨਾਲ ਡਾਕਟਰ ਦੇ ਸੰਪਰਕ ਵਿੱਚ ਰਹਿ ਕੇ ਦਿੰਦੇ ਹਨ ਅਤੇ ਬਜ਼ੁਰਗਾਂ ਦੇ ਮੰਜੇ ਬਿਸਤਰੇ ਨੂੰ ਸਾਫ ਰੱਖਦੇ ਹਨ ਅਤੇ ਉਹਨਾਂ ਦਾ ਪੂਰੇ ਤਰੀਕੇ ਨਾਲ ਸਫਾਈ ਦਾ ਧਿਹਾ ਧਿਆਨ ਦਿੱਤਾ ਜਾਂਦਾ ਹੈ ਜਿਸ ਨਾਲ ਬਜ਼ੁਰਗਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਅਤੇ ਖਾਣ ਪੀਣ ਦੇ ਵਿੱਚ ਵੀ ਉਹਨਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਜਿਸ ਨਾਲ ਉਹ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰ ਸਕਣ